ਥੋੜ੍ਹਾ ਟਾਇਮ ਪਹਿਲਾਂ ਮੈਂ ਸਪੋਰਟਸ ਦੀ ਕਿਤਾਬ ਪੜ੍ਹੀ ਤੀ ਜਿਸ ਵਿੱਚ ਗੇਮਾਂ ਬਾਰੇ ਦੱਸਿਆ ਗਿਆ ਤਾ ਜੀ ਜਿਸ ਤੋਂ ਪ੍ਰਭਾਵਿਤ ਵਾਲੀਬਾਲ ਅਤੇ ਜਿੰਮ ਬਾਰੇ ਦੱਸਿਆ ਗਿਆ ਤਾਂ ਉਹ ਮੈਨੂੰ ਜ਼ਿਆਦਾ ਇੰਟਰਸਟਿੰਗ ਲੱਗੀ ਜਿਸ ਨਾਲ਼ ਕਿ ਜਦੋਂ ਮੈਂ ਇਸ ਨੂੰ ਪੜ੍ਹਕੇ ਮੈਂ ਵਾਲੀਬਾਲ ਖੇਡਣ ਲੱਗਿਆ ਵਾਲੀਬਾਲ ਖੇਡ ਕੇ ਮੈਂ ਸੈਂਟਰ ਖੇਡਦੇ ਖੇਡਦੇ ਸੈਂਟਰ ਸੈਂਟਰ ਮੈ ਖੇਡਦਾ ਤਾ ਜਿਸ ਨਾਲ ਕਿ ਮੈਨੂੰ ਬਹੁਤ ਵਧੀਆ ਲੱਗਿਆ ਅਤੇ ਮੈਂ ਫਿਜੀਕਲ ਵੀ ਫਿਟ ਹੋ ਗਿਆ ਅਤੇ ਫਿਜੀਕਲ ਫਿੱਟ ਹੋਣ ਕਰਕੇ ਅਸੀਂ ਇੱਕ ਪਿੰਡ ਵਿੱਚ ਰੋਜ਼ਾਨਾ ਅਸੀਂ ਗੇਮ ਵਾਲੀਬਾਲ ਗੇਮ ਖੇਡਦੇ ਹਨ